ਭਾਰਤ ਦਾ ਵਿਰਸਾ ਸੱਭਿਆਚਾਰ ਬਹੁਤ ਪ੍ਰਾਚੀਨ ਅਤੇ ਅਮੀਰ ਹੈ ਪਰ ਭਾਰਤ ਵਿੱਚ ਜ਼ਿਆਦਾਤਰ ਬਾਹਰੋਂ ਹਮਲੇ ਹੋਏ ਹਨ ਜਿਵੇਂ ਮੁਗਲ ਲੋਕ ਅੰਗਰੇਜ਼ ਇਹਨਾਂ ਨੇ ਭਾਰਤ ਦੇ ਸਭਿਆਚਾਰ ਜਾਂ ਸ਼ੈਲੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਜਿਵੇਂ ਚਿੱਤਰਕਾਰੀ ਦੀਵਾਰਾਂ 'ਤੇ ਚਿੱਤਰਕਾਰੀ ਅਲੋਪ ਹੋ ਰਹੀ ਹੈ ਕਈ ਪੁਰਾਤਨ ਮਹਿਲ ਉੱਥੇ ਉਕਰੇ ਹੋਏ ਚਿੱਤਰ ਅਲੋਪ ਹੋ ਰਹੇ ਹਨ ਲਾਲ ਕਿਲ੍ਹਾ ਉਸ ਵਿੱਚ ਮੁਗਲਾਂ ਦੇ ਸਮੇਂ ਤੋਂ ਜੋ ਚਿੱਤਰਕਾਰੀ ਜਾਂ ਸ਼ੈਲੀ ਹੋਈ ਹੈ ਉਹ ਹੁਣ ਅਲੋਪ ਕੀਤੀ ਜਾ ਰਹੀ ਹੈ ਕਈ ਮਹਾਰਾਜੇ ਮਹਾਰਾਣੀਆਂ ਦੇ ਮਹਿਲ ਅਲੋਪ ਕੀਤੇ ਜਾ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਟੁੱਟਦੇ ਹੋਏ ਮਹਿਲਾਂ ਨੂੰ ਫਿਰ ਤੋਂ ਰਿਪੇਅਰ ਕੀਤਾ ਜਾਵੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਰਖਵਾਲੇ ਰੱਖਣ ਚਾਹੀਦੇ ਹਨ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਸੰਭਾਲ ਸਕਦੇ ਹਾਂ